ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਤੁਹਾਡੀ ਕੰਪਨੀ ਤੋਂ ਔਨਲਾਈਨ ਲੈਪਟੋਪ ਮੰਗਵਾਇਆ ਸੀ ਅਤੇ ਉਹ ਲੈਪਟੋਪ ਤੁਸੀਂ ਮੈਨੂੰ ਦਸ ਦਿਨ ਦਾ ਸਮਾਂ ਦਿੱਤਾ ਸੀ ਅਤੇ ਅੱਜ ਚੌਥੇ ਦਿਨ ਵਿੱਚ ਹੀ ਮੇਰੇ ਕੋਲ ਪਹੁੰਚ ਚੁੱਕਿਆ ਹੈ ਅਤੇ ਤੁਹਾਡੀ ਕੰਪਨੀ ਦਾ ਬੰਦਾ ਜੋ ਇਹ ਲੈਪਟੋਪ ਮੈਨੂੰ ਦੇ ਕੇ ਗਿਆ ਹੈ ਉਸਨੇ ਮੈਨੂੰ ਬਹੁਤ ਹੀ ਵਧੀਆ ਤਰੀਕੇ ਗੱਲ ਇਸਦੇ ਸਾਰੇ ਫੀਚਰਸ ਅਤੇ ਸਾਰਾ ਕੁਛ ਸਮਝਾਇਆ ਹੈ ਅਤੇ ਤੁਹਾਡੀ ਸਰਵਿਸ ਅਤੇ ਤੁਹਾਡੀ ਡਿਲੀਵਰੀ ਮੈਨੂੰ ਬਹੁਤ ਹੀ ਵਧੀਆ ਲੱਗੀ ਹੈ ਅਤੇ ਤੁਹਾਡਾ ਇਹ ਪ੍ਰੋਡਕਟ ਲੈਪਟੋਪ ਜਦੋਂ ਮੈਂ ਯੂਜ਼ ਕੀਤਾ ਮੈਨੂੰ ਬਹੁਤ ਹੀ ਵਧੀਆ ਲੱਗਿਆ ਤੁਸੀਂ ਇਹ ਬਹੁਤ ਹੀ ਘੱਟ ਸਹੀ ਰੇਟ 'ਤੇ ਮੈਨੂੰ ਇਹ ਪ੍ਰੋਡਕਟ ਦਿੱਤਾ ਹੈ ਅਤੇ ਇਹ ਅੱਜ ਜਦੋਂ ਮੇਰੇ ਯਾਰ ਦੋਸਤ ਮੇਰੇ ਕੋਲ ਆਏ ਉਹ ਮੈਨੂੰ ਮੇਰਾ ਲੈਪਟੋਪ ਦੇਖ ਰਹੇ ਸੀ ਜਾਂ ਅਤੇ ਉਹਨਾਂ ਨੇ ਮੈਨੂੰ ਪੁੱਛਿਆ ਅਤੇ ਮੈਂ ਉਹਨਾਂ ਨੂੰ ਸਾਰਾ ਕੁਛ ਦੱਸਿਆ ਵੀ ਮੈਂ ਇਸ ਰੇਟ 'ਤੇ ਇਹ ਲੈਪਟੋਪ ਖਰੀਦਿਆ ਹੈ ਅਤੇ ਉਹ ਵੀ ਇਹ ਚਾਹੁੰਦੇ ਹਨ ਕਿ ਉਹ ਵੀ ਇਹ ਲੈਪਟੋਪ ਤੋਂ ਖਰੀਦਣ ਅਤੇ ਮੈਂ ਤੁਹਾਡੀ ਰਿਕਮੈਂਡੇਸ਼ਨ ਉਹਨਾਂ ਨੂੰ ਕੀਤੀ ਹੈ ਸੋ ਕਿ ਉਹ ਵੀ ਲੈਪਟੋਪ ਤੋਂ ਹੀ ਖਰੀਦਣ ਮੈਨੂੰ ਤੁਹਾਡਾ ਲੈਪਟੋਪ ਬਹੁਤ ਹੀ ਪਸੰਦ ਆਇਆ ਹੈ ਬਹੁਤ ਹੀ ਸਹੀ ਰੇਟ 'ਤੇ ਤੁਸੀਂ ਮੈਨੂੰ ਇਹ ਲੈਪਟੋਪ ਦਿੱਤਾ ਹੈ ਮੈਂ ਇਸ ਲੈਪਟੋਪ ਨੂੰ ਲੈ ਕੇ ਬਹੁਤ ਹੀ ਖੁਸ਼ ਹਾਂ